ਹਾਂਜੀ ਗੱਲ ਇਹ ਆ ਵੀ ਆਪਣੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਤੁਹਾਡੇ ਕੀ ਸੁਝਾਅ ਨੇ ਮੈਂ ਕੀ ਸੁਝਾਅ ਦੇਵਾਂ ਸੁਝਾਅ ਤਾਂ ਇਹ ਆ ਸਭ ਤੋਂ ਵੱਡੀ ਗੱਲ ਮੇਨ ਇਹ ਆ ਵੀ ਜਦੋਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਹੁੰਦੇ ਸੀਗੇ ਬਹੁਤ ਜ਼ਿਆਦਾ ਸਾਦੇ ਹੁੰਦੇ ਸੀਗੇ ਉਸ ਦੇ ਵਿੱਚ ਕੀ ਹੁੰਦਾ ਸੀਗਾ ਦਾਲ ਰੋਟੀ ਅਤੇ ਸ ਇੱਕ ਸਬਜ਼ੀ ਹੁੰਦੀ ਸੀ ਕਿ ਇੱਕ ਮਿੱਠੇ ਦੇ ਵਿੱਚ ਇੱਕ ਖੀਰ ਬਣਾਈ ਜਾਂਦੀ ਹੁੰਦੀ ਸੀ ਕੜਾਹ ਹੁੰਦਾ ਸੀਗਾ ਅਤੇ ਅੱਜ ਕੱਲ੍ਹ ਕੀ ਆ ਅੱਜ ਕੱਲ੍ਹ ਇੰਨੇ ਜ਼ਿਆਦਾ ਫਜ਼ੂਲ ਖਰਚੀ ਆਪਾਂ ਨੇ ਕਰ ਲਈ ਨਾਲੇ ਤਾਂ ਪੈਸੇ ਦੀ ਕਾ ਬਰਬਾਦੀ ਕਰ ਰਹੇ ਹਾਂ ਨਾਲੇ ਆਪਾਂ ਆਪਣੇ ਆਪਣੇ ਪਰ ਕਰਜਾ ਚੜਾ ਰਹੇ ਹਾਂ ਜਦੋਂ ਕਿ ਪੁਰਾਣੇ ਸਮਿਆਂ ਦੇ ਵਿੱਚ ਸਾਦੇ ਵਿਆਹ ਹੁੰਦੇ ਸੀਗੇ ਸਾਦੇ ਰਿਵਾਜ਼ ਹੁੰਦੇ ਸੀਗੇ ਪਰ ਹੁਣ ਕੀ ਆ ਹੁਣ ਅੱਜ ਕੱਲ੍ਹ ਫੈਸ਼ਨ ਆ ਫੈਸ਼ਨ ਦੇ ਵਿੱਚ ਦੇਖੋ ਕੀ ਆ ਜੀਨਾਂ ਜੀਨਾਂ ਕ ਕਿੱਥੇ ਦਾ ਪਹਿਰਾਵਾ ਜੇ ਆਪਾਂ ਸੋਚੀਏ ਇਹ ਹੈਗਾ ਪਹਿਰਾਵਾ ਬਾਹਰਲੇ ਮੁਲਕਾਂ ਦਾ ਪੱਛਮ ਦਾ ਪਹਿਰਾਵਾ ਇਹ ਅਸੀਂ ਪੱਛਮ ਦੇ ਪਹਿਰਾਵੇ ਨੂੰ ਇੱਥੇ ਲੈ ਕੇ ਆਏ ਹਾਂ ਸਾੜਾ ਸਾਡਾ ਪਹਿਰਾਵਾ ਇਹ ਸੀਗਾ ਲੜਕੀਆਂ ਦੇ ਲਈ ਸਲਵਾਰ ਕਮੀਜ਼ ਉਹ ਉਸ ਨੂੰ ਸਾਨੂੰ ਪਹਿਲ ਦੇਣੀ ਚਾਹੀਦੀ ਹੈ ਅੱਜ ਕੱਲ੍ਹ ਮੁੰਡੇ ਕੀ ਹੈ ਮੁੰਡੇ ਕਟਿੰਗ ਕਰਾਉਂਦੇ ਹਨ ਸ਼ੇਪ ਕਰਾਉਂਦੇ ਹਨ ਕਟਿੰਗ ਉਹ ਜੋ ਕਿ ਸਾਡੇ ਧਰਮ ਦੇ ਵਿੱਚ ਧਰਮ ਦੇ ਵੀ ਖਿਲਾਫ ਹੈ ਅਤੇ ਸਾਡੇ ਸੱਭਿਆਚਾਰ ਦੇ ਵੀ ਖਿਲਾਫ ਹੈ ਉਹਨਾਂ ਨੂੰ ਆਪਣੀਆਂ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ ਅਰ ਦਾੜਾ ਪ੍ਰਕਾਸ਼ ਕਰਨਾ ਚਾਹੀਦਾ ਹੈ ਉਸ ਨਾਲ ਸਾਡਾ ਸੱਭਿਆਚਾਰ ਵੀ ਬਚਿਆ ਰਹੂਗਾ ਅਰ ਸਾਨੂੰ ਆਪਣੇ ਸਾਡੇ ਇਹ ਸੱਭਿਆਚਾਰ ਨਾਲ ਸਾਡੀ ਇੱਕ ਵੱਖਰੀ ਪਛਾਣ ਹੈ ਅਸੀਂ ਕਿਤੇ ਵੀ ਜਾਈਏ ਕਿਤੇ ਵੀ ਜਾਈਏ ਸਾਡਾ ਇੱਕ ਵੱਖਰਾ ਦੂਰ ਤੋਂ ਵਿੱਚ ਜਦੋਂ ਬੰਦਾ ਹਜ਼ਾਰ ਬੰਦਾ ਖੜ੍ਹਿਆ ਹੋਊਗਾ ਉਸ ਦੇ ਵਿੱਚ ਜੇ ਕਿਸੇ ਇੱਕ ਬੰਦੇ ਨੇ ਵੀ ਦਸਤਾਰ ਸਜਾਈ ਹੋਵੇ ਤਾਂ ਉਹ ਦਾੜਾ ਪ੍ਰਕਾਸ਼ ਕੀਤਾ ਹੋਇਆ ਤਾਂ ਉਹ ਬੰਦਾ ਕੋਈ ਵੀ ਬੰਦਾ ਤੀਜਾ ਬੰਦਾ ਦੱਸ ਸਕਦਾ ਹੈ ਵੀ ਇਹ ਸਿੱਖ ਹੈ ਜਿਵੇਂ ਕਿ ਸਾਡੇ ਸਿੱਧੂ ਮੂਸੇਵਾਲੇ ਨੇ ਸਾਡੇ ਸਿੱਧੂ ਮੂਸੇਵਾਲੇ ਨੇ ਪੱਗ ਦੀ ਇੰਨੀ ਜ਼ਿਆਦਾ ਸੰਸਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਪੱਗ ਦੀ ਇੰਨੀ ਜ਼ਿਆਦਾ ਮਹਾਨ ਆਪਣੀ ਪੱਗ ਦੀ ਸਾਡੀ ਪ ਪ੍ਰਸਿੱਧੀ ਕਰ ਦਿੱਤੀ ਸੀਗੀ ਸਾਨੂੰ ਵੱਖਰੀ ਪਛਾਣ ਮਿਲਣ ਲੱਗ ਗਈ ਸੀਗੀ ਪਰ ਉਸ ਦਾ ਕਤਲ ਹੋਣ ਨਾਲ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਸਾਨੂੰ ਇਹ ਘਾਟਾ ਨਾ ਪੂਰਾ ਹੋਣ ਵਾਲਾ ਪਿਆ ਹੈ ਇਸਦੇ ਪਿੱਛੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਿਉਂ ਕੀਤਾ ਗਿਆ ਹੈ